ਰੋਜ਼ੀ ਰੋਟੀ ਅਤੇ ਬਿਜਲੀ ਦਾ ਬਹੁਤ ਪ੍ਰਭਾਵ ਹੈ ਮੈਂ ਅਜਿਹਾ ਮੰਨਣਾ ਚਾਹੂੰਗਾ ਕਿ ਸਭ ਦੇ ਕੰਮ ਵਿੱਚ ਕਿੱਤੇ ਨਾ ਕਿੱਤੇ ਬਿਜਲੀ ਦਾ ਤਾਂ ਯੋਗਦਾਨ ਰਿਹਾ ਹੀ ਰਿਹਾ ਅਤੇ ਜਦੋਂ ਕੱਟ ਹੁੰਦੇ ਆ ਤਾਂ ਹਰ ਬਿਜਲੀ ਨਾਲ ਚੱਲ ਰਹੀ ਚੀਜ਼ਾਂ ਦਾ ਬੰਦ ਹੋਣਾ ਸੰਭਾਵਿਤ ਹੈ ਅਤੇ ਬਿਜਲੀ ਦੇ ਕੱਟ ਦੌਰਾਨ ਆਪਾਂ ਉਹ ਸਾਰੇ ਕੀਤੇ ਹੋਏ ਕੰਮ ਰੁਕ ਜਾਂਦੇ ਹਨ ਬਿਜਲੀ ਦੇ ਕੱਟ ਵਿੱਚ ਰੌਸ਼ਨੀ ਲਈ ਆਪਾਂ ਜੇ ਦਿਨ ਦਾ ਵੇਲਾ ਹੈ ਤਾਂ ਬਾਰੀਆਂ ਖੋਲ੍ਹ ਸਕਦੇ ਹਾਂ ਬਾਕੀ ਆਪਣੇ ਵਿੱਚ ਬਾਹਰ ਬੈਠ ਕੇ ਕੰਮ ਕਰ ਸਕਦੇ ਹਾਂ ਜੇ ਲਾਈਟ ਹੋਏ ਤਾਂ